ਇੱਥੇੇ ਲੋਕ ਕਈ ਕਿਸਮ ਦੀਆਂ ਫਸਲਾਂ ਜਾਂ ਪਸ਼ੂਆਂ ਦੀ ਖੇਤੀ ਕਰਦੇ ਹਨ ਜਿਵੇਂ ਕਿ ਫਸਲਾਂ ਵਿੱਚ ਜਿਵੇਂ ਕਿ ਕਣਕ ਝੋਨਾ ਮੱਕੀ ਆਲੂ ਗੰਨਾ ਬਾਜਰਾ ਅਤੇ ਪਿਆਜ਼ ਅਤੇ ਪਸ਼ੂਆਂ ਦੇ ਵਿੱਚ ਮੱਝਾਂ ਗਾਵਾਂ ਅਤੇ ਬੱਕਰੀਆਂ